ਭਾਰਤੀ ਸਮਾਜ ਵਿੱਚ ਧਰਮ ਦੀ ਬਹੁਤ ਭੂਮਿਕਾ ਹੈ ਭਾਰਤੀ ਸਮਾਜ ਧਰਮ ਦੇ ਸਹਾਰੇ ਹੀ ਹੈ ਇਸ ਵਿੱਚ ਧਰਮ ਦੀ ਬਹੁਤ ਭੂਮਿਕਾ ਹੈ ਅਤੇ ਭਾਰਤ ਵਿੱਚ ਅਨੇਕਾਂ ਧਰਮ ਹਨ ਜਿਸ ਤਰ੍ਹਾਂ ਕਿ ਮੁਸਲਿਮ ਧਰਮ ਹਿੰਦੂ ਧਰਮ ਸਿੱਖ ਧਰਮ ਇਸਾਈ ਧਰਮ ਪਾਰਸੀ ਧਰਮ ਇਸ ਤਰ੍ਹਾਂ ਵਗੈਰਾ ਵਗੈਰਾ ਹੋਰ ਵੀ ਕਈ ਧਰਮ ਹਨ ਅਤੇ ਸਾਰੇ ਧਰਮ ਠੀਕ ਹਨ ਧਰਮ ਕੋਈ ਮਾੜਾ ਨਹੀਂ ਧਰਮ ਜਿਹੜਾ ਹੈ ਇਹ ਇਨਸਾਨ ਨੂੰ ਇਨਸਾਨ ਨਾਲ ਜੋੜਦਾ ਹੈ ਅਤੇ ਸਾਨੂੰ ਦੂਜੇ ਧਰਮਾਂ ਦਾ ਉੰਨਾ ਹੀ ਸਤਿਕਾਰ ਕਰਨਾ ਚਾਹੀਦਾ ਹੈ ਜਿੰਨਾ ਅਸੀਂ ਆਪਣੇ ਧਰਮ ਨੂੰ ਕਰਦੇ ਹਾਂ ਪਰ ਦੇਖਣ ਵਿੱਚ ਆਇਆ ਹੈ ਕਿ ਕਈ ਧਰਮ ਜਿਹੜੇ ਹੈ ਧਰ ਧਰਮ ਦੇ ਮਤਲਬ ਕਿ ਪੈਰੋਕਾਰ ਅਸੀਂ ਕਹਿ ਸਕਦੇ ਹਾਂ ਧਰਮ ਕੋਈ ਵੀ ਮਾੜਾ ਨਹੀਂ ਹੈ ਧਰਮ ਦੇ ਕਈ ਪਰ ਪੈਰੋਕਾਰ ਜਾਂ ਉਹਨੂੰ ਸੰਭਾਲਣ ਵਾਲੇ ਥੋੜ੍ਹੇ ਜਿਹੇ ਕੱਟੜ ਹੋ ਜਾਂਦੇ ਹਨ ਜੋ ਕਿ ਬੜੀ ਗਲਤ ਗੱਲ ਹੈ ਕੱਟੜਤਾ ਨਹੀਂ ਚਾਹੀਦੀ ਫਲੈਕਸੀਬਿਲਿਟੀ ਚਾਹੀਦੀ ਹੈ ਲਚਕ ਚਾਈਹੀ ਹੈ ਚਾਹੀਦੀ ਹੈ ਕਿ ਆਪਣੇ ਧਰਮ ਨੂੰ ਵੀ ਮੰਨੋ ਅਤੇ ਦੂਜਿਆਂ ਦਾ ਵੀ ਸਤਿਕਾਰ ਕਰੋ ਕਿਉਂਕਿ ਭਾਰਤ ਜਿਹੜਾ ਹੈ ਅਨੇਕਤਾ ਵਿੱਚ ਏਕਤਾ ਨੂੰ ਮੰਗਦਾ ਹੈ ਅਤੇ ਸਾਨੂੰ ਇੱਕ ਹੋ ਕੇ ਰਹਿਣਾ ਚਾਹੀਦਾ ਹੈ ਸਾਡਾ ਭਾਰਤੀ ਸੱਭਿਆਚਾਰ ਭਾਰਤੀ ਸਮਾਜ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਇੱਕ ਹਾਂ ਹਿੰਦੁਸਤਾਨੀ ਹਾਂ ਭਾਰਤੀ ਹਾਂ ਅਤੇ ਚੰਗੇ ਨਾਗਰਿਕ ਬਣਨ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਅਤੇ ਤਾਂਹੀਓਂ ਜਿਹੜਾ ਭਾਰਤ ਜਿਹੜਾ ਤਰੱਕੀ ਕਰੇਗਾ ਖੁਸ਼ਹਾਲ ਹੋਵੇਗਾ ਵਿਕਾਸ ਕਰੇਗਾ ਅਤੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਮੋਹਰੀ ਭੂਮਿਕਾ ਨਿਭਾਏਗਾ